ਰੋਪੜ ਜ਼ਿਲ੍ਹੇ ਦਾ ਮੌਸਮ ਠੰਢਾ ਅਤੇ ਗਰਮ ਦੋਨੋਂ ਦੋਨੋਂ ਹੀ ਹੈ ਗਰਮ ਜੂਨ ਜੁਲਾਈ ਦੇ ਮਹੀਨੇ ਵਿੱਚ ਉਰੇ ਜ਼ਿਆਦਾ ਹੀ ਗਰਮੀ ਪੈਂਦੀ ਹੈ ਅਤੇ ਬਾਰਿਸ਼ ਕਦੇ ਕਦੇ ਹੀ ਪੈਂਦੀ ਹੈ ਹੈ ਸਾਵਣ ਦੇ ਮਹੀਨੇ ਵਿੱਚ ਬਾਰਿਸ਼ ਤੇਜ਼ ਹੋਣ ਕਰਕੇ ਕਈ ਕਈ ਸੜਕਾਂ ਰੂਪਨਗਰ ਜ਼ਿਲ੍ਹੇ ਦੀ ਪਾਣੀ ਨਾਲ ਭਰ ਜਾਂਦੀ ਹਾਂ ਕਿਉਂਕਿ ਉਰੇ ਪਾਣੀ ਨਿਕਲਣ ਦਾ ਜ਼ਿਆਦਾ ਵਧੀਆ ਸਾਧਨ ਨਹੀਂ ਹੈਗਾ ਹੈਗਾ ਅਤੇ ਲੋਕਾਂ ਨੂੰ ਥੋੜ੍ਹੀ ਜਿਹੀ ਦਿੱਕਤ ਹੁੰਦੀ ਹੈ ਬਾਰਿਸ਼ ਦੇ ਮੌਸਮ ਵਿੱਚ ਠੰਡ ਦੇ ਮੌਸਮ ਵਿੱਚ ਵਿੱਚ ਵੈਸੇ ਤਾਂ ਕੋਈ ਦਿੱਕਤ ਦਿੱਕਤ ਦੀ ਗੱਲ ਨਹੀਂ ਹੈ ਹੈ ਪਰ ਬਾਰਿਸ਼ ਦੇ ਮੌਸਮ ਵਿੱਚ ਰੂਪਨਗਰ ਜਿਲ੍ਹੇ ਵਿੱਚ ਆਵਾਜਾਈ ਦੀ ਦਿੱਕਤ ਹੋ ਜਾਂਦੀ ਹੈ ਗਰਮੀਆਂ ਦੇ ਮੌਸਮ ਵਿੱਚ ਲੋਕ ਉਰੇ ਛੱਤਰੀ ਲੈ ਕੇ ਘਰ ਤੋਂ ਬਾਹਰ ਨਿਕਲਦੇ ਕਿਉਂਕਿ ਉਰੇ ਦੀ ਗਰਮੀ ਬਹੁਤ ਜ਼ਿਆਦਾ ਚੁੱਭਦੀ ਹੈ ਅਤੇ ਅਗਰ ਕੋਈ ਤੁਰ ਕੇ ਜਾਂਦਾ ਹੈ ਤਾਂ ਉਸ ਦੀ ਤਾਂ ਹਾਲਤ ਹੀ ਖਰਾਬ ਹੋ ਜਾਂਦੀ ਹੈ